ਪੰਜ ਮਾਰਚ ਉੱਨੀ ਪਚਾਨਵੇਂ ਦਸ ਦਸੰਬਰ ਵੀਹ ਦਸ ਪੱਚੀ ਨਵੰਬਰ ਵੀਹ ਸਤਾਰਾਂ ਉੱਨੀ ਫਰਵਰੀ ਵੀਹ ਬਾਈ ਤੇਰਾਂ ਅਪ੍ਰੈਲ ਵੀਹ ਤੇਈ